ਹਾਂਜੀ ਕੋਣ ਹਾਂਜੀ ਗੱਲ ਕਰ ਰਹੀ ਹਾਂ ਤੁਸੀਂ ਕੋਣ ਓਕੇ ਹਾਂਜੀ ਕਿਵੇਂ ਹੋ ਤੁਸੀਂ ਹਾਂਜੀ ਮੈਂ ਵੀ ਵਧੀਆ ਇਸ਼ਿਕਾ ਨੇ ਦੱਸਿਆ ਸੀਗਾ ਤੁਹਾਡੇ ਬਾਰੇ ਕਿ ਤੁਸੀਂ ਇੱਥੇ ਪੰਜਾਬ ਘੁੰਮਣ ਲਈ ਆਉਣਾ ਅਤੇ ਖ਼ਾਸ ਕਰ ਤੁਸੀਂ ਮਾਨਸਾ ਜ਼ਿਲ੍ਹੇ ਵਿਚ ਘੁੰਮਣ ਆਉਣਾ ਹਾਂ ਮੈਂ ਮੈਂ ਤੁਹਾਡੀ ਗਾਈਡ ਹੋਊਂਗੀ ਤੁਹਾਨੂੰ ਸਾਰਾ ਕੁਛ ਗਾਈਡ ਕਰੂੰਗੀ ਹਾਂ ਦੱਸੋ ਬਈ ਕਿਵੇਂ ਲੱਗਿਆ ਸਾਰਾ ਪੰਜਾਬ ਹਾਂਜੀ ਬੋਲੋ ਹਾਂਜੀ ਆਪਣੇ ਆ ਬਠਿੰਡੇ ਦੇ ਨੀਅਰ ਹੀ ਪੈਂਦੇ ਮਾਨਸੇ ਦੇ ਨੀਅਰ ਹੀ ਏਅਰਪੋਰਟ ਉੱਥੇ ਘੁੰਮਣਾ ਹੈ ਤਾਂ ਫਿਰ ਤੁਸੀਂ ਉੱਥੇ ਏਅਰਪੋਰਟ 'ਤੇ ਜਾ ਜਾ ਸਕਦੇ ਹੋ ਕਾਫ਼ੀ ਵਧੀਆ ਫੈਸੀਲੀਟੀ ਹੁੰਦੀ ਹੈ ਉੱਥੇ ਹਾਂਜੀ ਅਤੇ ਆਪਣੇ ਜੇ ਤੁਸੀਂ ਮਾਨਸਾ ਵਿੱਚ ਘੁੰਮਣਾ ਤਾਂ ਉੱਥੇ ਵੀ ਕਾਫ਼ੀ ਚੀਜ਼ਾਂ ਨੇ ਘੁੰਮਣ ਨੂੰ ਇੱਥੇ ਜਿਹੜੇ ਜਿਵੇਂ ਕਿ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਗਿਆ ਸੀਗਾ ਉਹਦੀ ਹੈ ਨਾ ਪੁਰਾਣੀ ਹਵੇਲੀ ਸੀ ਨਵੀਂ ਹਵੇਲੀ ਹੈ ਉਹ ਸਾਰਾ ਕੁਛ ਮਾਨਸੇ ਵਿੱਚ ਹੀ ਹੈ ਮਤਲਬ ਉਹਦੇ ਵਿੱਚ ਵੀ ਜਿਹੜੀ ਗੱਡੀ ਵਿੱਚ ਉਹਨੂੰ ਮਾਰਿਆ ਗਿਆ ਸੀਗਾ ਉਹ ਗੱਡੀ ਵੀ ਉੱਥੇ ਰੱਖੀ ਗਈ ਹੈ ਕਾਫ਼ੀ ਉਹਦੀ ਸਾਰੀਆਂ ਚੀਜ਼ਾਂ ਉਹਦੇ ਮੰਮੀ ਪਾਪਾ ਵੀ ਉਹ ਸਾਰੇ ਵੀ ਇੱਧਰ ਹੀ ਹੈਗੇ ਨੇ ਅਤੇ ਤੁਸੀਂ ਮਤਲਬ ਉੱਥੇ ਜਾ ਸਕਦੇ ਹੋ ਘੁੰਮਣ ਅਤੇ ਇੱਥੇ ਬਹੁਤ ਭੀੜ ਹੁੰਦੀ ਹੈ ਰੋਜ਼ ਹੀ ਮਤਲਬ ਬਹੁਤ ਲੋਕ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਇੱਥੇ ਆਉਂਦੇ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਉਹਦੇ ਰਿਲੇਟਿਡ ਉਹ ਰੁਮਾਲ ਕਾਫ਼ੀ ਛੱਲੇ ਕਾਪੀਆਂ ਪੈਨਸਿਲ ਬੈਗ ਕੁਛ ਵੀ ਲੈਣਾ ਉਹ ਮਤਲਬ ਸਾਰਾ ਕੁਛ ਤੁਹਾਨੂੰ ਉਹਦੇ ਰਿਲੇਟਡ ਮਿਲ ਸਕਦਾ ਹਾਂਜੀ ਹੋਰ ਦੱਸੋ ਤੁਸੀਂ ਹਾਂਜੀ ਫਿਰ ਮੈਂ ਉੱਥੇ ਬਹੁਤ ਹੀ ਮੈਂ ਮਤਲਬ ਤੁਹਾਨੂੰ ਬਹੁਤ ਹੀ ਵਧੀਆ ਕਨਫਰਟੇਬਲ ਸੀਟਿੰਗ ਦਊਂਗੀ ਮਤਲਬ ਤੁਹਾਨੂੰ ਖਾਣ ਪੀਣ ਦੀ ਕੋਈ ਚਿੰਤਾਂ ਨਾ ਕਰਿਓ ਤੁਸੀਂ ਤੁਸੀਂ ਸਾਰਾ ਕੁਛ ਪ੍ਰੋਪਰ ਤੁਹਾਨੂੰ ਮਿਲੇਗਾ ਅਤੇ ਬਾਕੀ ਜਦੋਂ ਤੁਹਾਨੂੰ ਏਅਰਪੋਰਟ 'ਤੇ ਪਿੱਕਅਪ ਕਰਨ ਜਾਂ ਤਾਂ ਮੈਂ ਹੋਊਂਗੀ ਜਾਂ ਫਿਰ ਡਰਾਇਵਰ ਤੁਸੀਂ ਮੇਰੇ ਨਾਲ ਡੀਟੇਲ ਵਗੈਰਾ ਸਾਰਾ ਕੁਛ ਸ਼ੇਅਰ ਕਰ ਦਿਓ ਵੀ ਤੁਸੀਂ ਕਦੋਂ ਤੱਕ ਇੱਥੇ ਪਹੁੰਚੋਗੇ ਤਾਂ ਉਸ ਹਿਸਾਬ ਨਾਲ ਮੈਂ ਫਿਰ ਆ ਜਾਵਾਂਗੀ ਹਾਂਜੀ ਮੈਂ ਤੁਹਾਨੂੰ ਕਾਰ ਦਾ ਕੀ ਕਹਿੰਦੇ ਹੈ ਸ਼ੇਅਰ ਕਰਦੂੰਗੀ ਅਤੇ ਤੁਸੀਂ ਉਸ ਹਿਸਾਬ ਨਾਲ ਇਹ ਦੇਖ ਲਿਓ ਚੈੱਕ ਕਰ ਲਿਓ ਹਾਂਜੀ ਓਕੇ ਓਕੇ ਥੈਂਕ ਵੈਲਕਮ ਜੀ ਵੈਲਕਮ